ਹਰ ਇੱਕ ਜਗ੍ਹਾ ਦੀ ਅਲੱਗ ਅਲੱਗ ਪਰੰਪਰਾਵਾਂ ਹਨ ਜਿੱਥੇ ਕਿ ਗੱਚਕ ਇੱਕ ਇੱਕ ਗੁੜ ਦੇ ਨਾਲ ਅਤੇ ਮੂੰਫਲੀਆਂ ਦੇ ਨਾਲ ਤਿਆਰ ਕੀਤੀ ਜਾਣ ਵਾਲੀ ਇੱਕ ਖਾਦਯ ਪਦਾਰਥ ਹੈ ਜਿਹਦੇ ਜਿਹੜਾ ਕਿ ਮਿੱਠਾ ਹੈ ਮਿੱਠਾ ਪਦਾਰਥ ਹੈ ਜਿਹਦੇ ਨਾਲ ਕਿ ਆਪਾਂ ਇੱਕ ਦੂਜੇ ਨੂੰ ਖਵਾ ਕੇ ਖੁਸ਼ੀਆਂ ਮਨਾਉਂਦੇ ਹਨ ਸਾਡੇ ਘਰ 'ਚ ਖੀਰ ਦਾ ਬਹੁਤ ਵੱਡਾ ਖੀਰ ਦੀ ਬਹੁਤ ਵੱਡੀ ਪਰੰਪਰਾ ਹੈ ਕਿ ਸਾਡੇ ਘਰ 'ਚ ਜਦੋਂ ਵੀ ਕੋਈ ਚੰਗੀ ਚੀਜ਼ ਹੋਏ ਤਾਂ ਖੀਰ ਜ਼ਰੂਰ ਬਣਦੀ ਆ ਬੇਸਨ ਬੇਸਣ ਦੀ ਚੀਜ਼ਾਂ ਬਹੁਤ ਸਾਡੇ ਪੰਜਾਬ ਮਸ਼ਹੂਰ ਹਨ ਬੇਸਣ ਵੀ ਬੇਸਣ ਦੇ ਲੱਡੂ ਬੇਸਣ ਦੀ ਕੋਈ ਵੀ ਮਿਠਾਈ ਹੋ ਗਈ ਉਸ ਚੀਜ਼ ਨੂੰ ਇਹ ਹਰ ਇਕ ਚੀਜ਼ 'ਚ ਰੱਖਦੇ ਹਨ ਜੇ ਤਾਂ ਅ ਬੇਸਣ ਵੀ ਸੇਮੀਆਂ ਹੋ ਗਈਆਂ ਹਰ ਇੱਕ ਚੀਜ਼ ਨਾ ਵਿਸਾਖੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹਨੂੰ ਚੂਜ਼ ਕੀਤੀਆਂ ਜਾਂਦੀਆਂ ਨੇ ਵਿਸਾਖੀ ਦੇ ਵਿੱਚ ਸਾਡੇ ਆਟੇ ਦਾ ਕੜਾਹ ਬ ਬਣਦਾ ਹੈ ਘਰਾਂ ਦੇ ਵਿੱਚ ਕਿਉਂਕਿ ਆਟ ਉਸ ਟਾਈਮ 'ਤੇ ਕਣਕ ਦੀ ਪਹਿਲੀ ਵਾਢੀ ਹੁੰਦੀ ਹੈ ਇਸ ਲਈ ਆਟੇ ਦਾ ਕੜਾਹ ਬਣਦਾ ਹੈ ਜੇ ਆਪਾਂ ਲੋਹੜੀ ਦੀ ਗੱਲ ਕਰੀਏ ਲੋਹੜੀ ਦੇ ਵਿੱਚ ਖੀ ਗੰਨੇ ਦੀ ਖੀਰ ਬੜੀ ਮਸ਼ਹੂਰ ਹੈ ਜਿੱਥੇ ਕਿ ਆਪਾਂ ਗੰਨੇ ਦੀ ਖੀਰ ਖਾ ਕੇ ਇੱਕ ਦੂਜੇ ਦੇ ਨਾਲ ਪ੍ਰਗਟਾਵਾ ਪੇਸ਼ ਕਰਦੇ ਹਾਂ ਉਹਦੇ ਵਿੱਚ ਵੀ ਚੋਲ ਗੰਨੇ ਗੰਨੇ ਦਾ ਰਸ ਵਿੱਚ ਮੂੰਗਫਲੀਆਂ ਪਾ ਕੇ ਬਦਾਮ ਪਾ ਕੇ ਉਸ ਚੀਜ਼ ਨੂੰ ਸਹੀ ਕਰਦੇ ਹਾਂ ਉਸ ਚੀਜ਼ ਨੂੰ ਮਿੱਠਾ ਬਣਾਉਂਦੇ ਹਾਂ ਇਸ ਚੀਜ਼ ਨਾਲ ਪ੍ਰਗਟਾਵਾ ਹੁੰਦਾ ਹੈ